ਹਾਂਜੀ ਤੁਸੀਂ ਚੰਦਰਾਵਤੀ ਹੋਸਪਿਟਲ ਤੋਂ ਬੋਲਦੇ ਹੋ ਹਾਂਜੀ ਮੈਂ ਹਾਂਜੀ ਮੈਂ ਰੋਮੀਕਾ ਬੋਲਦੀ ਹਾਂ ਮੈਨੂੰ ਡਾਕਟਰ ਸਿੰਮੀ ਨਾਲ ਗੱਲ ਕਰਨੀ ਸੀ ਹੋ ਜਾਵੇਗੀ ਚਲੋ ਮੈਨੂੰ ਐਪੋਆਇੰਟਮੈਂਟ ਦਾ ਮਤਲਬ ਲੈਣੀ ਪਵੇਗੀ ਅਤੇ ਫਿਰ ਕਦੋਂ ਤੱਕ ਐਪੋਆਇੰਟਮੈਂਟ ਮਿਲ ਜਾਵੇਗੀ ਮੈਨੂੰ ਠੀਕ ਹੈ ਮੈਨੂੰ ਨਾ ਹਾਂਜੀ ਹਾਂਜੀ ਮੈਨੂੰ ਨਾ ਯੂਟ੍ਰੈਸ ਦੀ ਥੋੜ੍ਹੀ ਪ੍ਰੋਬਲਮ ਹੈ ਹਾਂਜੀ ਉਹ ਮਤਲਬ ਜਿਵੇਂ ਯੂਰੈਨ ਦੇ ਵਿੱਚ ਇੰਨਫੈਕਸ਼ਨ ਥੋੜ੍ਹੀ ਬਹੁਤ ਜਿਵੇਂ ਆਉਂਦੀ ਆ ਇਹ ਮੈਨੂੰ ਪੰਦਰਾਂ ਕੁ ਦਿਨ ਹੋ ਗਏ ਹੈ ਮੈਂ ਦਵਾਈ ਕਾਫੀ ਖਾਧੀ ਆ ਲੇਕਿਨ ਮੈਨੂੰ ਆਰਾਮ ਨਹੀਂ ਆ ਰਿਹਾ ਹਾਂਜੀ ਹਾਂਜੀ ਹਾਂਜੀ ਅਤੇ ਉਹ ਜਦੋਂ ਇਹ ਵਾਲਾ ਜਦੋਂ ਅਲਟਰਾ ਸਾਊਂਡ ਕਰਵਾਉਣਾ ਇਹ ਫਿਰ ਬਾਥਰੂਮ ਦਾ ਪ੍ਰੈਸ਼ਰ ਵੀ ਕਾਫੀ ਹੋਣਾ ਚਾਹੀਦਾ ਜਾਂ ਇਹ ਹੋ ਜੇਗਾ ਐਵੇਂ

ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਮੈਂ ਡਾਕਟਰ ਸਾਹਿਬ ਨਾਲ ਇਹ ਵੀ ਗੱਲ ਕਰਨੀ ਸੀ ਮੈਨੂੰ ਥੋੜ੍ਹੀ ਪੀਰੀਅਡਸ ਦੀ ਵੀ ਪ੍ਰੋਬਲਮ ਰਹਿੰਦੀ ਆ ਮੈਨੂੰ ਮਤਲਬ ਕਾਫੀ ਦਿਨ ਹੋ ਜਾਂਦੇ ਹੈ ਲੀਹ 'ਤੇ ਆਂ ਪੀਰੀਅਡਸ ਨਹੀਂ ਆ ਪਾ ਰਹੇ ਮੈਨੂੰ ਸ਼ਾਇਦ ਪਤਾ ਨਹੀਂ ਤਾਂ ਹੀ ਇੰਨਫੈਕਸ਼ਨ ਹੈ ਸਮਝ ਨਹੀਂ ਆ ਰਿਹਾ ਜੀ ਮੇਰੇ ਜੇ ਮੇਰੇ ਕੋਲ ਆਧਾਰ ਕਾਰਡ ਨਾ ਹੋਵੇ ਇਕੱਲੇ ਵੋਟਰ ਕਾਰਡ ਨਾਲ ਕੰਮ ਚਲ ਜੇਗਾ

ਚਲੋ ਦੇਖ ਲੂੰਗੀ ਮੈਂ ਮੇਰਾ ਹਾਂਜੀ ਕੋਈ ਗੱਲ ਨਹੀਂ ਮੈਂ ਉਹ ਨਾ ਮੇਰਾ ਦਰਅਸਲ ਗੁੰਮ ਗਿਆ ਸੀ ਆਧਾਰ ਕਾਰਡ ਅਤੇ ਹੁਣ ਨਵਾਂ ਹਾਂਜੀ ਕੋਈ ਨਹੀਂ ਉਹ ਵੀ ਕਰਵਾ ਲਾਵਾਂਗੇ ਕਿਉਂਕਿ ਨਵਾਂ ਬਣਨਾ ਦਿੱਤਾ ਹੋਇਆ ਜੇ ਬ ਆ ਹਜੇ ਤੱਕ ਬਣ ਕੇ ਆਇਆ ਨਹੀਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਬਾਕੀ ਤੁਸੀਂ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਮੈਂ ਤਾਂ ਹੀ ਪੁੱਛ ਲਿਆ ਨਾ ਕਈ ਵਾਰ ਕੋਈ ਕੋਈ ਅਤੇ ਇਹ ਮੈਂ ਕਿੰਨੇ ਵਜੇ ਤੱਕ ਆ ਸਕਦੀ ਹਾਂ ਫਿਰ ਅੱਛਾ ਜੀ ਕਿਉਂਕਿ ਐਵੇਂ ਨਾ ਦਸ ਵਜੇ ਤੱਕ ਹਾਂਜੀ ਹਾਂਜੀ ਹਾਂਜੀ ਪਲੀਜ਼ ਮਤਲਬ ਨਾ ਪਹਿਲਾਂ ਹੀ ਮੇਰਾ ਨੰਬਰ ਲਗਵਾ ਦਿਓ ਕਿਉਂਕਿ ਇੰਨੀ ਦੇਰ ਨਾ ਫਿਰ ਬਾਥਰੂਮ ਦਾ ਪ੍ਰੈਸ਼ਰ ਦੀ ਵੀ ਦਿੱਕਤ ਹੋ ਜਾਂਦੀ ਹੈ ਫਿਰ ਮੇਰੇ ਪੇਨ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ